ਇਸ ਬਾਰੇ ਸੋਚੋ ਕਿ ਤੁਸੀਂ ਲੈਗਿਨਸ ਸੈਕਸ਼ਨ ਵਿੱਚ ਕਿਵੇਂ ਜਾਵੋਗੇ ਅਤੇ ਆਪਣੀ ਪਸੰਦੀਦਾ ਰੰਗ ਅਤੇ ਆਕਾਰ ਵਿੱਚ ਉਪਲਬਧਤਾ ਦੀ ਜਾਂਚ ਕਰੋਗੇ ਤੁਸੀਂ ਕੀ ਕਦਮ ਚੱਕੋਗੇ ਹਾਂਜੀ ਅਸੀਂ ਵਧੀਆ ਜੀ ਐਪ ਲੱਭਾਂਗੇ ਉਹਦੇ ਵਿੱਚ ਅਸੀਂ ਲੈਗਿੰਗ ਦਾ ਮਤਲਬ ਸਲੈਕਸ਼ਨ ਕਰਾਂਗੇ ਉਹਦੇ ਵਿੱਚ ਪਹਿਲਾਂ ਮੈਂ ਆਪਣਾ ਸਾਈਜ਼ ਦੇਖਾਂਗੀ ਕਲਰ ਵੀ ਦੇਖਾਂਗੀ ਅਤੇ ਮਤਲਬ ਲੈਂਥ ਕਲਰ ਸਾਈਜ਼ ਸਭ ਕੁਝ ਮਤਲਬ ਦੇਖ ਕੇ ਫਿਰ ਸਲੈਕਟ ਕਰਾਂਗੀ ਅਤੇ ਇਹਦੇ ਦਰਮਿਆਨ ਅਸੀਂ ਮਤਲਬ ਹੋਰ ਵੀ ਮਤਲਬ ਵੈਬਸ ਹਨ ਜਿੱਥੇ ਲੈਗਿੰਗਸ ਵਗੈਰਾ ਵਧੀਆ ਨੇ ਪਰ ਮੈਂ ਜ਼ਿਆਦਾ ਆਨਲਾਈਨ ਸ਼ੋਪਿੰਗ ਕਰਨਾ ਪਸੰਦ ਤਾਂ ਨਹੀਂ ਕਰਦੀ ਅਤੇ ਬਾਕੀ ਲੈਗਿੰਗਜ਼ ਤਾਂ ਦੇਖਣਾ ਹੋਵੇ ਤਾਂ ਆਪਾਂ ਮਤਲਬ ਐਪ ਤੋਂ ਹੀ ਮਤਲਬ ਆਰਡਰ ਕਰ ਸਕਦੇ ਹਾਂ